ਜੇਕਰ ਆਪਾਂ ਪੰਜਾਬ ਦੇ ਨਾਗਰਿਕਾਂ ਦੀ ਸਿਆਸੀ ਪ੍ਰਕਿਰਿਆ ਦੇ ਵਿੱਚ ਹਿੱਸੇਦਾਰੀ ਵੇਖੀਏ ਤਾਂ ਉਹ ਵੋਟਿੰਗ ਦੇ ਰਾਹੀਂ ਜਾਂ ਤਾਂ ਪ੍ਰਚਾਰ ਕਰਨ ਦੇ ਰਾਹੀਂ ਦੇਖ ਸਕਦੇ ਹਾਂ ਜਿਵੇਂ ਕਿ ਕੋਈ ਵੀ ਪਾਰਟੀ ਪੋਲੀਟੀਕਲ ਪਾਰਟੀ ਕੱਲ੍ਹ ਨੂੰ ਆਪਣੀ ਰੈਲੀ ਕੱਢੇ ਭਾਵੇਂ ਉਹ ਬਾਈਕ ਰੈਲੀ ਹੋਵੇ ਭਾਵੇਂ ਉਹ ਸਟੇਜ ਰੈਲੀ ਹੋਵੇ ਜੇਕਰ ਉਹ ਆਪਣੀ ਪੈਦਲ ਰੈਲੀ ਵੀ ਕੱਢਦੀ ਹੈ ਤਾਂ ਉਹਦੇ ਵਿੱਚ ਸ਼ਾਮਿਲ ਹੋ ਕੇ ਨਾਗਰਿਕ ਜਿਹੜੇ ਹੈ ਉਹ ਆਪਣੀ ਹਿੱਸੇਦਾਰੀ ਦਰਜ ਕਰ ਸਕਦੇ ਹਨ ਅਤੇ ਵੋਟਿੰਗ ਦੇ ਰਾਹੀਂ ਜੋ ਕਿ ਬਹੁਤ ਪ੍ਰਮੁੱਖ ਮੰਨਿਆ ਜਾਂਦਾ ਹੈ ਵੋਟਿੰਗ ਦੇ ਰਾਹੀਂ ਲੋਕ ਆਪਣੇ ਸਿਆਸੀ ਆਗੂਆਂ ਦਾ ਚੋਣ ਕਰ ਸਕਦੇ ਹਨ ਚੁਣਾਵ ਆਪਣੇ ਭਾਰਤ ਭਰ ਦੇ ਵਿੱਚ ਬਹੁਤ ਮਹੱਤਵਪੂਰਨ ਹੈਗੇ ਹਨ ਪੰਜਾਬ ਦੇ ਵਿੱਚ ਵੀ ਜੇਕਰ ਆਪਾਂ ਦੇਖੀਏ ਤਾਂ ਤਿੰਨ ਪਾਰਟੀਆਂ ਮੁੱਖ ਤੌਰ 'ਤੇ ਹੈਗੀਆਂ ਨੇ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਇੱਕ ਕਾਂਗਰਸ ਜਿਨ੍ਹਾਂ ਵਿੱਚੋਂ ਅੱਜ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਪਾਵਰ ਦੇ ਵਿੱਚ ਹੈਗੀ ਹੈ ਅਤੇ ਇਹ ਮੁਮਕਿਨ ਹੋ ਪਾਇਆ ਸਿਰਫ਼ ਨਾਗਰਿਕਾਂ ਦੀ ਵੋਟਿੰਗ ਦੇ ਕਾਰਣ ਹੀ ਅਤੇ ਇਸ ਲਈ ਨਾਗਰਿਕਾਂ ਦੀ ਵੋਟਿੰਗ ਇੱਕ ਬਹੁਤ ਮਹੱਤਵਪੂਰਨ ਹਿੱਸੇਦਾਰੀ ਆਪਣੀ ਦਿੰਦੀ ਹੈ ਆਉਣ ਵਾਲੀ ਸਰਕਾਰ ਦੇ ਲਈ